ਗਰੀਬੀ ਦੀ ਗੱਲ ਕਰੀਏ ਜਾਂ ਬੇਰੁਜ਼ਗਾਰੀ ਦੀ ਗੱਲ ਕਰੀਏ ਕਿਉਂਕਿ ਇਹ ਤਾਂ ਅਮਰ ਸਿਖਰਾਂ 'ਤੇ ਬਹੁਤ ਜ਼ਿਆਦਾ ਗਰੀਬੀ ਹੈ ਬਹੁਤ ਜ਼ਿਆਦਾ ਪੰਜਾਬ ਵਿੱਚ ਪੜ੍ਹੇ ਲਿਖੇ ਨੌਜਵਾਨ ਗ੍ਰੈਜੂਏਸ਼ਨ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੌਜਵਾਨ ਬਿਨਾਂ ਨੌਕਰੀਆਂ ਤੋਂ ਤੁਰੇ ਫਿਰਦੇ ਆ ਵਿਹਲੇ ਕੋਈ ਨੌਕਰੀ ਨਹੀਂ ਅਤੇ ਪੰਜਾਬ ਸਰਕਾਰ ਗਰੀਬੀ ਘਟਾਉਣ ਦੀ ਬਜਾਏ ਤਾਂ ਵਧਾ ਰਹੀ ਹੈ ਕਿਉਂਕਿ ਜਿਹਨਾਂ ਨੂੰ ਨੌਕਰੀ ਦੇਣੀਆਂ ਸੀ ਜਿਹਨਾਂ ਗਰੀਬਾਂ ਦੇ ਵਿੱਚ ਇਹਨੂੰ ਨੌਕਰੀ ਦੇਣਾ ਸੀ ਉਹਨਾਂ ਨੂੰ ਆਟੇ ਅਤੇ ਦਾਲ ਅਤੇ ਕਣਕਾਂ 'ਤੇ ਲਾ ਕੇ ਉਹਨਾਂ ਦੀ ਗਰੀਬੀ ਆ ਜਿਹੜੀ ਉਹ ਵਧਾ ਦਿੱਤੀ ਆ ਜਿਹੜੀ ਉਹਨਾਂ ਦੀ ਮਾਨਸਿਕ ਤਾਂ ਉਹ ਕਮਜ਼ੋਰ ਕਰਤੀ ਕਿਉਂਕਿ ਉਹਨਾਂ ਦੀ ਸੋਚਣ ਸਕਤੀ ਸੋਚਣ ਜਿਹੜੀ ਸਕਤੀ ਹੈ ਘ ਘਟਾ ਤੀ ਕਿਉਂਕਿ ਉਹਨਾਂ ਦਾ ਜਿਹੜਾ ਮਨ ਹੈ ਉਹ ਇੱਥੇ ਤੱਕ ਸੀਮਤ ਰਹਿ ਗਿਆ ਕਿ ਬਸ ਆਟੇ ਦਾਲ ਤੱਕ ਨੌਕਰੀਆਂ ਮਿਲਣ ਦੀ ਉਹਦੇ ਮੰਗਣ ਦੇ ਉਹਨੇ ਜਿਹੜੇ ਜਾਂਚ ਆ ਉਹ ਘਟਾ ਦਿੱਤੀ ਹੈ ਸਰਕਾਰ ਕਰ ਅਤੇ ਕੁਝ ਨਹੀਂ ਰਹੀ ਬਸ ਆਪੋ ਆਪਣੇ ਹਰ ਇੱਕ ਨੂੰ ਜਿਹੜਾ ਸਰਕਾਰ ਨੂੰ ਮਸਲਾ ਸਿਰਫ ਇਕੱਲਾ ਕੁਰਸੀ ਤੱਕ ਮਸਲਾ ਹੁੰਦਾ ਹਰ ਇੱਕ ਸਰਕਾਰ ਆਉਂਦੀ ਹੈ ਵਾਅਦੇ ਤਾਂ ਬੜੀ ਕਰਦੀ ਹੈ ਕਿ ਨੌਕਰੀ ਦੇਵਾਂਗੇ ਜਾਂ ਆਹ ਕਰਾਂਗੇ ਪਰ ਕਰ ਕੁਝ ਨਹੀਂ ਰਹੀ ਸੋ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਨੌਜਵਾਨ ਜਿਹੜੇ ਬੇਰੁਜ਼ਗਾਰ ਹੈ ਪੜ੍ਹੇ ਲਿਖੇ ਨੇ ਗ੍ਰੈਜੂਏਸ਼ਨ ਨੇ ਐਮ ਏ ਬੀਐਡ ਨੇ ਉਹਨਾਂ ਨੂੰ ਨੌਕਰੀ ਦੇਣੇ ਚਾਹੀਦੀ ਹੈ ਅਤੇ ਗਰੀਬੀ ਹੈ ਇਹ ਤਾਂ ਦੂਰ ਹੋਵੇਗੀ ਜੇ ਉਹਨਾਂ ਦੇ ਨੌਜਵਾਨ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਧੰਨਵਾਦ